ਸਾਡੇ ਖੇਤਰ ਵਿੱਚ ਬਹੁਤ ਹੀ ਖਿਡਾਰੀਆਂ ਲਈ ਸੰਸਥਾ ਹਨ ਜੋ ਕਿ ਸਾਨੂੰ ਪਿੰਡ ਪੰਚਾਇਤ ਵੀ ਆਈ ਪੀ ਕਲਚਰ ਜਾਂ ਸਰਕਾਰ ਗੌਰਮੈਂਟ ਵੱਲੋਂ ਮਿਲਦੀ ਹਨ ਜੋ ਕਿ ਪਿੱਛਾ ਤੋਂ ਗ੍ਰਾਂਟ ਹੀ ਸਰਕਾਰ ਵੱਲ ਤੋਂ ਆਉਂਦੀ ਆ ਸਾਡੇ ਖਿਡਾਰੀਆਂ ਲਈ ਖਾਣ ਪੀਣ ਦਾ ਸਮਾਨ ਖੇਡਾਂ ਦਾ ਸਮਾਨ ਜੋ ਕਿ ਸਪੋਰਟ ਵਿਚ ਜੋ ਕਿ ਹਿੱਸਾ ਲੈਂਦੇ ਆ ਪਾਰਟੀਸਪੇਟ ਕਰਦੇ ਆ ਖੇਡਦੇ ਹਨ ਮੋਹਰੇ ਹੋ ਕੇ ਸਟੇਟ ਚੈਂਪੀਅਨ ਇੰਟਰਨੈਸ਼ਨਲ ਚੈਂਪੀਅਨ ਉਹਨਾਂ ਵਾਸਤੇ ਬਹੁਤ ਹੀ ਸਮਾਨਿਤ ਪੰਚਾਇਤ ਦੇ ਵਿੱਚ ਕੀਤਾ ਜਾਂਦਾ ਹੈ ਉਰੇ ਜੋ ਵੀ ਉਹਨਾਂ ਨੂੰ ਸਮਾਨ ਦੀ ਲੋੜ ਹੁੰਦੀ ਹੈ ਉਰੇ ਸਾਰੀ ਹੀ ਚੀਜ਼ਾਂ ਉਪਲਬਧ ਹੁੰਦੀਆਂ ਹਨ ਪੰਚਾਇਤ ਤੌਰ 'ਤੇ ਉਹਨਾਂ ਨੂੰ ਮਿਲ ਜਾਂਦੀਆਂ ਹਨ ਸਰਕਾਰ ਗੌਰਮੈਂਟ ਤੌਰ 'ਤੇ ਆ ਜਾਂਦੀਆਂ ਹਨ ਅਤੇ ਵੀ ਆਈ ਪੀ ਕਲਚਰ ਵੱਲ ਇੱਧਰ ਐੱਨ ਆਰ ਈ ਵੱਲ ਦੇ ਸਭ ਨੇ ਸਹੂਲਤਾਂ ਉਰੇ ਮਿਲ ਜਾਂਦੀ ਹਨ ਖੇਤਰਾਂ ਵਿੱਚ